ਪੰਜਾਬ ਵਿੱਚ ਸਿਹਤ ਸੰਭਾਲ ਸੁਧਾਰ ਕ ਲ ਕਰਨ ਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਪਹਿਲ ਕਦਮੀਆਂ ਲਈਆਂ ਗਈਆਂ ਹਨ ਇਹਨਾਂ ਵਿੱਚ ਬਹੁਤ ਸਾਰੀਆਂ ਨੀਤੀਆਂ ਇੱਦਾਂ ਦੀਆਂ ਹਨ ਜੋ ਕਿ ਲੋਕਾਂ ਦੀ ਬਹੁਤ ਮਦਦ ਕਰਦੀਆਂ ਹਨ ਸਿਹਤ ਸੰਭਾਲ ਦੇ ਲਈ ਇਹਨਾਂ ਵਿੱਚੋਂ ਕੁਝ ਕੁ ਸਕੀਮ ਦੇ ਬਾਰੇ ਮੈਂ ਬੋਲਣਾ ਚਾਹੁੰਦੀ ਹਾਂ ਜਿਵੇਂ ਕਿ ਇੱਕ ਹੈ ਆਯੂਸ਼ਮਾਨ ਸਕੀਮ ਇਹਦੇ ਵਿੱਚ ਇਲਾਜ ਦੇ ਲਈ ਪੰਜ ਲੱਖ ਰੁਪਏ ਤੱਕ ਜਿਹੜੇ ਦਿੱਤੇ ਜਾਂਦੇ ਆ ਗਰੀਬ ਲੋਕਾਂ ਨੂੰ ਜਿਹੜੇ ਕਿ ਪਾਵਰਟੀ ਲਾਈਨ ਤੋਂ ਥੱਲੇ ਰਹਿੰਦੇ ਆ ਇਹ ਤੋਂ ਬਿਨਾਂ ਇੱਕ ਟੀ ਬੀ ਕੰਟਰੋਲ ਸਕੀਮ ਹੈ ਜਿਹਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਫਰੀ ਦੇ ਵਿੱਚ ਜਿਹੜੀ ਆ ਸਾਰੀਆਂ ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ ਜਿਹਦੇ ਵਿੱਚ ਉਹਨਾਂ ਦੇ ਟੈਸਟ ਤੋਂ ਲੈ ਕੇ ਛੇ ਮਹੀਨੇ ਤੱਕ ਦੀਆਂ ਫਰੀ ਦੀਆਂ ਜਿਹੜੀਆਂ ਮੈਡੀਸਨ ਆ ਉਹ ਗਰੀ ਉਹ ਹਰ ਇੱਕ ਪਰਸਨ ਨੂੰ ਜਿਹੜੀ ਆ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈ ਇਹ ਤੋਂ ਬਿਨਾਂ ਜਨਨੀ ਸੁਰੱਖਿਆ ਯੋਜਨਾ ਹੈ ਜਿਹਦੇ ਵਿੱਚ ਪ੍ਰੈਗਨੈਂਟ ਜਿਹੜੀਆਂ ਅ ਔਰਤਾਂ ਹੁੰਦੀਆਂ ਹਨ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਸਿਹਤ ਸੰਭਾਲ ਦੇ ਲਈ ਜਿਹੜਾ ਆ ਸੱਤ ਸੌ ਰੁਪਏ ਪ੍ਰਤ ਪ੍ਰਤੀ ਮਹੀਨਾ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਇਹ ਤੋਂ ਬਿਨਾਂ ਉਹਨਾਂ ਦੇ ਜਿੰਨੀਆਂ ਵੀ ਸਕੈਨਿੰਗ ਵਗੈਰਾ ਹੁੰਦੀਆਂ ਹਨ ਅਤੇ ਉਤ ਅ ਬੱਚਾ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਅ ਬਹੁਤ ਸਾਰੀਆਂ ਇੱਦਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਦੀ ਸਿਹਤ 'ਤੇ ਕੋਈ ਵੀ ਮਾੜਾ ਅਸਰ ਨਾ ਹੋਏ ਇਹ ਤੋਂ ਬਿਨਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਜਿਹੜੀ ਆ ਉਹ ਵੀ ਪੰਜਾ ਚੱਲ ਰਹੀ ਆ ਜਿਹਦੇ ਵਿੱਚ ਹੁੰਦਾ ਹੈ ਕਿ ਤੁਹਾ ਇੱਕ ਕੈਂਸਰ ਪੇਸ਼ੈਂਟ ਨੂੰ ਜਿਹੜਾ ਆ ਉਹ ਡੇਢ ਲੱਖ ਤੱਕ ਜਿਹੜਾ ਆ ਰੁਪਏ ਜਿਹੜੇ ਆ ਉਹ ਦਿੱਤੇ ਜਾਂਦੇ ਹਨ ਆਪਣੇ ਕੈਂਸਰ ਦਾ ਇਲਾਜ ਕਰਵਾਉਣ ਦੇ ਲਈ ਇਹਦੇ ਤੋਂ ਬਿਨਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜਿਹੜੀ ਹੈ ਉਹ ਵੀ ਚੱਲ ਰਹੀ ਹੈ ਜਿਹਦੇ ਵਿੱਚ ਜਿਹੜੇ ਪਾਵਰਟੀ ਲਾਈਨ ਤੋਂ ਨੀਚੇ ਰਹਿ ਰਹੇ ਲੋਕ ਹੁੰਦੇ ਆ ਉਹਨਾਂ ਨੂੰ ਪੰਜਾਹ ਹਜ਼ਾਰ ਤੱਕ ਜਿਹੜੇ ਆ ਉਹਦਾ ਬੀਮਾ ਦਿੱਤਾ ਜਾਂਦਾ ਹੈ ਆਪਣੇ ਟਰੀਟਮੈਂਟ ਦੇ ਲਈ ਇਹਦੇ ਤੋਂ ਬਿਨਾਂ ਇੱਕ ਐਂਬੂਲੈਂਸ ਸਕੀਮ ਵੀ ਚੱਲ ਰਹੀ ਹੈ ਜਿਹਦੇ ਵਿੱਚ ਤੁਸੀਂ ਇੱਕ ਸੌ ਅੱਠ ਨੰਬਰ ਡਾਇਲ ਕਰਕੇ ਕਿਸੇ ਵੀ ਟਾਈਮ ਜਿਹੜੀ ਆ ਐਬੂਲੈਂਸ ਕਿਸੇ ਵੀ ਜਗ੍ਹਾ 'ਤੇ ਬੁਲਾ ਸਕਦੇ ਹੋ ਅਤੇ ਉਹਦੀਆਂ ਜਿਹੜੀਆਂ ਹੈ ਸੇਵਾਵਾਂ ਜਿਹੜੀਆਂ ਹੈ ਉਹ ਲੈ ਸਕਦੇ ਹੋ